ਵੈਸੇ ਤਾਂ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ ਜਿਹਨਾਂ ਵਿੱਚ ਕਿ ਜਿੱਦਾਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਆਯੁਸ਼ਮਾਨ ਯੋਜਨਾ ਪੈਨਸ਼ਨ ਯੋਜਨਾ ਫਰੀ ਰਾਸ਼ਨ ਯੋਜਨਾ ਅਤੇ ਇੰਸ਼ੋਰੈਂਸ ਇਹ ਜਿਹੜੇ ਸੀਨੀਅਰ ਸਿਟੀਜਨਾਂ ਵਾਸਤੇ ਅਤੇ ਦੂਸਰੇ ਗਰੀਬ ਲੋਕਾਂ ਵਾਸਤੇ ਇਹ ਯੋਜਨਾ ਚਲਾਈਆਂ ਹਨ ਜਿਹਨਾਂ ਦਾ ਫਾਇਦਾ ਲੋਕ ਜਿਹੜੇ ਗਰੀਬ ਬੰਦੇ ਹਨ ਜਿਹੜਾ ਕਿ ਇਹਨਾਂ ਚੀਜ਼ਾਂ ਨੂੰ ਵੈਸੇ ਨਹੀਂ ਲੈ ਸਕਦੇ ਉਹ ਇਹਨਾਂ ਚੀਜ਼ਾਂ ਸਕੀਮਾਂ ਦਾ ਫਾਇਦਾ ਲੈ ਰਹੇ ਹਨ ਅਤੇ ਜਿੱਦਾਂ ਜੋ ਕਿ ਗਰੀਬ ਬੰਦਿਆਂ ਵਾਸਤੇ ਬਹੁਤ ਹੀ ਵਧੀਆ ਹੈ ਜਿਹਦੇ ਨਾਲ ਕਿ ਜੈਸੇ ਜਿੱਦਾਂ ਕਿ ਸੀਨੀਅਰ ਸਿਟੀਜਨ ਜਾਂ ਸੱਤਰ ਸਾਲ ਤੋਂ ਉੱਪਰ ਵਾਲੇ ਕੋਈ ਵੀ ਬੰਦਾ ਜਿਹੜਾ ਹੈ ਉਹ ਆਯੁਸ਼ਮਾਨ ਯੋਜਨਾ ਦਾ ਲਾਭ ਲੈ ਸਕਦਾ ਹੈ ਜਿਹਦੇ ਨਾਲ ਕਿ ਉਹਨਾਂ ਨੂੰ ਪੰਜ ਲੱਖ ਤੱਕ ਦੀ ਫਰੀ ਮੈਡੀਕਲ ਮਿਲ ਸਕਦਾ ਹੈ ਇਸ ਤਰ੍ਹਾਂ ਜੋ ਗਰੀਬ ਬੰਦੇ ਰੋਟੀ ਪਾਣੀ ਨਹੀਂ ਆਪਣਾ ਚਲਾ ਸਕਦੇ ਉਹਨਾਂ ਨੂੰ ਸਰਕਾਰ ਹਰ ਮਹੀਨੇ ਰਾਸ਼ਨ ਫਰੀ ਦਿੰਦੀ ਹੈ ਅਤੇ ਇਸ ਤਰ੍ਹਾਂ ਜਿਹੜੇ ਵਿਧਵਾ ਜਾਂ ਦੂਸਰੇ ਗਰੀਬ ਔਰਤਾਂ ਹਨ ਉਹਨਾਂ ਵਾਸਤੇ ਜਾਂ ਗਰੀਬ ਸੀਨੀਅਰ ਸਿ ਬਜ਼ੁਰਗ ਹਨ ਉਹਨਾਂ ਵਾਸਤੇ ਸਰਕਾਰ ਨੇ ਇੱਕ ਪੈਨਸ਼ਨ ਯੋਜਨਾ ਚਲਾਈ ਹੈ ਜਿਹੜੀ ਕਿ ਹਰ ਮਹੀਨੇ ਉਹਨਾਂ ਨੂੰ ਪੰਦਰ੍ਹਾਂ ਸੌ ਰੁਪਈਆ ਮਹੀਨਾ ਦੇ ਦਿੰਦੀ ਹੈ ਜਿਸ ਨਾਲ ਕਿ ਉਹਨਾਂ ਦੇ ਘਰ ਦਾ ਸਾਰਾ ਖਰਚਾ ਕਾਫੀ ਹੱਦ ਤੱਕ ਚੱਲ ਜਾਂਦਾ ਹੈ ਇਸ ਤਰ੍ਹਾਂ ਮੈਨੂੰ ਪਤਾ ਲੱਗੇ ਸਾਡੇ ਗੁਆਂਢ ਵਿੱਚ ਕੁਝ ਗਰੀਬ ਬੰਦੇ ਰਹਿੰਦੇ ਹਨ ਜਿਹੜੇ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਰਹੇ ਹਨ ਅਤੇ ਅਸੀਂ ਚਾਹੁੰ ਮੈਂ ਇਸ ਖੁਸ਼ੀ ਕਰਦਾ ਹਾਂ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਸਕੀਮਾਂ ਨੂੰ ਬੰਦ ਨਾ ਕੀਤਾ ਜਾਵੇ ਅਤੇ ਇਹ ਸਕੀਮਾਂ ਚਲਾਈਆਂ ਜਾਣ ਜਿਹਨਾਂ ਨਾਲ ਕਿ ਗਰੀਬ ਬੰਦਿਆਂ ਦਾ ਜਿਹੜੇ ਬੰਦੇ ਆਪਣਾ ਰੋਜ਼ੀ ਰੋਟੀ ਨਹੀਂ ਕਮਾ ਸਕਦੇ ਚੱਜ ਨਾਲ ਉਹਨਾਂ ਨੂੰ ਫਾਇਦਾ ਮਿਲ ਸਕੇ